ਲੋਕਡਾਊਨ ਦੇ ਵਿੱਚ ਅਸੀਂ ਕੁਕਿੰਗ ਕਰਨ ਦੇ ਵਿੱਚ ਬਹੁਤ ਹੀ ਮਜ਼ਾ ਕੀਤਾ ਜਿਸ ਤਰ੍ਹਾਂ ਇੱਕ ਦਿਨ ਸਾਡੇ ਬੱਚੇ ਕਹਿੰਦੇ ਕਿ ਅਸੀਂ ਚਨੇ ਭਟੂਰੇ ਖਾਣੇ ਹੈ ਛੋਲੇ ਭਟੂਰੇ ਅਸੀਂ ਛੋਲੇ ਭਟੂਰੇ ਬਣਾਏ ਇੱਕ ਦਿਨ ਅਸੀਂ ਜਲੇਬੀਆਂ ਬਣਾਈਆਂ ਅਤੇ ਲੋਕਡਾਊਨ ਦੇ ਵਿੱਚ ਤਾਂ ਇਹ ਹਾਲ ਸੀਗਾ ਕਿ ਮੈਦੇ ਦਾ ਇੱਕ ਪੈਕਟ ਦੋ ਦਿਨਾਂ ਦੇ ਵਿੱਚ ਹੀ ਲੱਗ ਜਾਂਦਾ ਸੀਗਾ ਕਦੇ ਉਹਦੇ ਮੱਠੀਆਂ ਮਟਰ ਬਣਾ ਲਉ ਕਦੇ ਉਹਦੇ ਮਿੱਠੇ ਮਟਰ ਬਣਾ ਲਉ ਕਦੇ ਛੋਟੇ ਭਟੂਰੇ ਬਣਾ ਲਉ ਕਦੇ ਜਲੇਬੀਆਂ ਬਣਾ ਲਉ ਅਸੀਂ ਤਾਂ ਇੱਕ ਹੋਰ ਵੀ ਕੀਤਾ ਨਾ ਅਸੀਂ ਨਾਨ ਵੀ ਬਣਾਏ ਘਰ ਲੋਕਡਾਊਨ ਦੇ ਵਿੱਚ ਨਾਨ ਅਤੇ ਪਨੀਰ ਦੀ ਗ੍ਰੇਵੀ ਦੇ ਨਾਲ ਬੱਚੇ ਸਾਡੇ ਕਹਿੰਦੇ ਕਹਿੰਦੇ ਕਿ ਇਹ ਤੋਂ ਜੋ ਨਾਨ ਅਤੇ ਗ੍ਰੇਵੀ ਹੈ ਇਹ ਤਾਂ ਰੈਸਟੋਰੈਂਟ ਦੇ ਵਿੱਚ ਵੀ ਅਜਿਹੀ ਨਹੀਂ ਮਿਲਦੀ ਜਿਹੜੀ ਸਾਡੇ ਮਾਂ ਬਾਪ ਨੇ ਘਰ ਬਣਾ ਕੇ ਦਿੱਤੀ ਹੈ ਲੋਕਡਾਊਨ ਦੇ ਵਿੱਚ ਮੈਦਾ ਅਸੀਂ ਬਹੁਤ ਵਰਤਿਆ ਮੈਦੇ ਦੇ ਨਾਲ ਨਾਲ ਸੂਜੀ ਦੀਆਂ ਵੀ ਬਹੁਤ ਚੀਜ਼ਾਂ ਅਸੀਂ ਬਣਾਈਆਂ